ਹਾਂਜੀ ਖਾਲਸਾ ਕੈਬ ਏਜੰਸੀ ਤੋਂ ਗੱਲ ਕਰ ਰਹੇ ਹੋ ਮੈਂ ਗੁਰਸੇਵਕ ਸਿੰਘ ਗੱਲ ਕਰ ਰਿਹਾ ਹਾਂ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਤੋਂ ਮੈਂ ਸ਼ਾਮ ਨੂੰ ਅੱਜ ਚਾਰ ਵਜੇ ਦੇ ਕਰੀਬ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਪੁੱਜਣਾ ਹੈ ਔਰ ਮੈਂ ਉੱਥੇ ਜਾਣ ਦੇ ਲਈ ਤੁਹਾਡੀ ਕੈਬ ਦੀ ਫੈਸਿਲਿਟੀ ਲੈਣਾ ਚਾਹੁੰਦਾ ਕਿਰਪਾ ਕਰਕੇ ਮੈਨੂੰ ਕੋਈ ਕੈਬ ਦੱਸੋ ਜਿਹਦੇ ਨਾਲ਼ ਮੈਨੂੰ ਇੱਕ ਤਾਂ ਜਾਣ ਆਉਣ ਜਾਣ ਲਈ ਸਮਾਂ ਘੱਟ ਲੱਗੇ ਔਰ ਦੂਸਰਾ ਉਹਦਾ ਖਰਚਾ ਘੱਟ ਆਵੇ ਜੇਕਰ ਕੈਬ ਦੀ ਜਗ੍ਹਾ ਤੇ ਮੈਨੂੰ ਕੋਈ ਆਟੋ ਫੈਸਲਿਟੀ ਮਿਲ ਸਕਦੀ ਹੈ ਤਾਂ ਕਿਰਪਾ ਕਰਕੇ ਮੈਨੂੰ ਉਹਦੇ ਬਾਰੇ ਵੀ ਦੱਸੋ ਕਿ ਜਿਹਦੇ ਨਾਲ਼ ਮੇਰਾ ਜਿਹੜਾ ਹੈਗਾ ਕਰਾਇਆ ਘੱਟ ਲੱਗੇ ਅਤੇ ਮੈਂ ਆਸਾਨੀ ਨਾਲ਼ ਹਾਈ ਕੋਰਟ ਵਿਖੇ ਪਹੁੰਚ ਸਕਾਂ